ਹੈਲੋ ਜੀ ਮੇਰਾ ਸਮਾਰਟਫੋਨ ਮੈਂ ਇੱਕ ਓਨਲਾਈਨ ਮੰਗਵਾਇਆ ਸੀ ਪਰ ਮੈਨੂੰ ਹਾਲੇ ਤੱਕ ਆਇਆ ਨਹੀਂ ਇਹ ਕਦੋਂ ਤੱਕ ਦਿੱਤਾ ਜਾਵੇਗਾ ਅਤੇ ਇਹਦੇ ਕੀ ਕੋਈ ਅਪਡੇਟ ਹਨ ਮੈਨੂੰ ਬਹੁਤ ਸਮਾਂ ਹੋ ਗਿਆ ਹੈ ਇਸ ਨੂੰ ਓਨਲਾਈਨ ਓਰਡਰ ਕੀਤੇ ਹੋਏ ਪਰ ਅਜੇ ਤੱਕ ਨਹੀਂ ਆਇਆ ਹੈ ਨਾਲ ਹੁਣ ਮੈਨੂੰ ਇਸ ਗੱਲ ਦੀ ਬਹੁਤ ਚਿੰਤਾ ਹੋ ਰਹੀ ਹੈ ਕਿਉਂਕਿ ਉਹ ਸਮਾਰਟਫੋਨ ਕਾਫੀ ਮਹਿੰਗਾ ਸੀ ਤੁਸੀਂ ਕਿਰਪਾ ਕਰਕੇ ਮੈਨੂੰ ਦੱਸ ਦਿਉ ਕਿ ਉਹ ਹਾਲੇ ਕਿੱਥੇ ਹੈ ਨਾਲ ਕਦੋਂ ਤੱਕ ਦਿੱਤਾ ਜਾਵੇਗਾ